ਛੋਟੇ ਹੁੰਦਿਆਂ ਉੱਚਾਈ ਤੋਂ ਬਹੁਤ ਹੀ ਜ਼ਿਆਦਾ ਡਰ ਲੱਗਦਾ ਹੁੰਦਾ ਸੀ ਇੱਥੋਂ ਤੱਕ ਕਿ ਪੌੜੀਆਂ ਚੜ੍ਹਨੀਆਂ ਵੀ ਇਕੱਲੇ ਨੂੰ ਬਹੁਤ ਜ਼ਿਆਦਾ ਡਰ ਆਉਂਦਾ ਸੀ ਫੇਰ ਮਾਤਾ ਪਿਤਾ ਨੇ ਹੌਲੀ ਹੌਲੀ ਮੈਨੂੰ ਉੱਚਾਈਆਂ 'ਤੇ ਲਿਜਾਣਾ ਸ਼ੁਰੂ ਕੀਤਾ ਹੌਲੀ ਹੌਲੀ ਪਹਿਲਾਂ ਜਿੱਦਾਂ ਕਿ ਛੱਤ ਤੇ ਲਿਜਾਣਾ ਸ਼ੁਰੂ ਕੀਤਾ ਫੇਰ ਹੋਰ ਪਹਾੜਾਂ ਦੀ ਸੈਰ ਕਰਵਾਈ ਹੌਲੀ ਹੌਲੀ ਇੱਦਾਂ ਕਰਦੇ ਕਰਦੇ ਜੋ ਮੇਰਾ ਉੱਚਾਈਆਂ ਦਾ ਡਰ ਸੀ ਉਹ ਖਤਮ ਹੁੰਦਾ ਗਿਆ ਇਸ ਵਿੱਚ ਸਭ ਤੋਂ ਜ਼ਿਆਦਾ ਸਹਾਇਤਾ ਮੇਰੀ ਮੇਰੇ ਮਾਤਾ ਪਿਤਾ ਨੇ ਕਰੀ ਹੈ ਮੇਰਾ ਇਹ ਡਰ ਦੂਰ ਕਰਨ ਦੇ ਵਿੱਚ ਵੀ ਤਾਂ ਜੋ ਉੱਚਾਈਆਂ ਤੋਂ ਡਰਨਾ ਨਹੀਂ ਚਾਹੀਦਾ ਇਹਨਾਂ ਦਾ ਸਾਹਮਣਾ ਕਰਨਾ ਚਾਹੀਦਾ